ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਸਨ ਪੌਦਿਆਂ ਨਾਲ ਹੀ ਸਾਨੂੰ ਆਕਸੀਜਨ ਮਿਲਦੀ ਹੈ ਸਾਨੂੰ ਸਮੇਂ ਸਮੇਂ ਸਿਰ ਪੌਦਿਆਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਸਮੇਂ ਦੇ ਹਿਸਾਬ ਨਾਲ ਪਾਣੀ ਦੇਣਾ ਗੁਡਾਈ ਕਰਨੀ ਸਾਨੂੰ ਵੱਧ ਤੋਂ ਵੱਧ ਦੇਸੀ ਖਾਦ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ ਜ਼ਿਆਦਾ ਖਾਦਾਂ ਸਪਰੇਹਾਂ ਤੋਂ ਪੌਦਿਆਂ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ ਜ਼ਿਆਦਾ ਪੌਦਿਆਂ ਵਧ ਵਧੀਆ ਪੌਦੇ ਲਗਾਉਣ ਨਾਲ ਹੀ ਵਾਤਾਵਰਨ ਸ਼ੁੱਧ ਰਹਿੰਦਾ ਹੈ ਸਾਨੂੰ ਜਿਸ ਤਰ੍ਹਾਂ ਆਪਾਂ ਸਮੇਂ ਸਿਰ ਫਲ ਫਲ ਵਾਲੇ ਬੂਟਿਆਂ ਦੇ ਫਲ ਤੋੜਨੇ ਚਾਹੀਦੇ ਹਨ ਜਦੋਂ ਜ਼ਿਆਦਾ ਫਲ ਪੱਕ ਕੇ ਥੱਲੇ ਗਿਰਦੇ ਸਨ ਤਾਂ ਉਸਦੇ ਉਹ ਵੀ ਸਿਹਤ ਉਹ ਵੀ ਨਹੀਂ ਗਿਰਨੇ ਚਾਹੀਦੇ ਸਾਨੂੰ ਸਮੇਂ ਸਿਰ ਫਲ ਤੋੜ ਪੱਕ ਕੇ ਫਲ ਤੋੜ ਲੈਣੇ ਚਾਹੀਦੇ ਸਨ ਕੱਚੇ ਫਲ ਨਹੀਂ ਤੋੜਨੇ ਚਾਹੀਦੇ ਸਾਨੂੰ ਸਮੇਂ ਸਿਰ ਫਲ ਵਾਲੇ ਬੂਟੇ ਜ਼ਿਆਦਾ ਤੋਂ ਜ਼ਿਆਦਾ ਲਗਾਉਣੇ ਚਾਹੀਦੇ ਸਨ ਜਿਸ ਤਰ੍ਹਾਂ ਕਿ ਕਹਿੰਦੇ ਨੇ ਕਿ ਰਾਤ ਨੂੰ ਪੁਰਾਣੇ ਸਮਿਆਂ ਵਿੱਚ ਮੰਨਿਆ ਜਾਂਦਾ ਸੀ ਕਿ ਰਾਤ ਨੂੰ ਫਲ ਨਹੀਂ ਤੋੜਨੇ ਚਾਹੀਦੇ ਚਾਹੇ ਬੂਟੇ ਨੂੰ ਹਿਲਾਉਣਾ ਨਹੀਂ ਚਾਹੀਦਾ ਕਿਉਂਕਿ ਰਾਤ ਦੇ ਸਮੇਂ ਪੌਦੇ ਸੁੱਤੇ ਹੁੰਦੇ ਨੇ ਇਸ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਨੇ ਤਾਂ ਜੋ ਵਾਤਾਵਰਨ ਸੁਰੱਖਿਅਤ ਰਹਿ ਸਕੇ ਅਤੇ ਸਾਨੂੰ ਆਕਸੀਜਨ ਮਿਲ ਸਕੇ